ਵਿਆਹ ਵਰਗੇ ਵੱਡੇ ਸਮਾਰੋਹਾਂ ਦੌਰਾਨ ਵੱਡੀ ਮਾਤਰਾ ਵਿੱਚ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਾਣੀ ਤੋਂ ਬਿਨਾਂ ਸਾਡਾ ਕੋਈ ਵੀ ਕੰਮ ਨਹੀਂ ਹੋ ਸਕਦਾ ਹੈ ਕੋਈ ਵੀ ਫੰਕਸ਼ਨ ਹੋਵੇ ਜਿਵੇਂ ਵਿਆਹ ਕੋਈ ਫੰਕਸ਼ਨ ਕੋਈ ਪ੍ਰੋਗਰਾਮ ਕੁਝ ਵੀ ਹੋਵੇ ਤਾਂ ਉਸ ਵਿੱਚ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਪਾਣੀ ਨਹੀਂ ਹੋਵੇਗਾ ਤਾਂ ਕੋਈ ਵੀ ਕੰਮ ਨਹੀਂ ਹੋ ਸਕਦਾ ਹੈ ਇਸ ਲਈ ਸਾਡੇ ਸਾਰੇ ਕੰਮ ਵਿੱਚ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ ਮੈਂ ਮੇਰੇ ਘਰ ਪਿਛਲੇ ਹਫਤੇ ਇੱਕ ਫੰਕਸ਼ਨ ਸੀ ਮੈਂ ਪਾਣੀ ਦੇ ਦੋ ਟੈਂਕਰ ਮੰਗਾਵਾਏ ਸੀ ਜਿ ਜਿਸਦਾ ਕੁੱਲ ਖਰਚਾ ਪੰਜ ਹਜ਼ਾਰ ਆਇਆ ਸੀ ਮੈਂ ਕੰਮ ਕਰਨ ਵਾਲਿਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪਾਣੀ ਦਾ ਇਸਤੇਮਾਲ ਚੰਗੀ ਤਰ੍ਹਾਂ ਕੀਤਾ ਜਾਵੇ ਤਾਂ ਕਿ ਪਾਣੀ ਦਾ ਵਰਤੋਂ ਸਹੀ ਤਰ੍ਹਾਂ ਹੋਵੇ ਤਾਂ ਜੋ ਪਾਣੀ ਦਾ ਚੰਗੀ ਤਰ੍ਹਾਂ ਇਸਤੇਮਾਲ ਕੀਤਾ ਜਾਵੇ ਪਾਣੀ ਵੇਸਟ ਨਾ ਹੋਵੇ ਇਸ ਕਾਰਨ ਮੈਂ ਉਹਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਬਰਤਨ ਧੋਣਾ ਖਾਣਾ ਬਣਾਉਣਾ ਜਾਂ ਕੁਛ ਵੀ ਕਰਨਾ ਹੋਵੇ ਤਾਂ ਪਾਣੀ ਦਾ ਸਹੀ ਮਾਤਰਾ ਵਿੱਚ ਇਸਤੇਮਾਲ ਕੀਤਾ ਜਾਵੇ ਕਿਉਂਕਿ ਪਾਣੀ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ ਹੈ ਇਸ ਲਈ ਸਾਡੇ ਡੇਲੀ ਲਾਈਫ ਵਿੱਚ ਪਾਣੀ ਦਾ ਇਸਤੇਮਾਲ ਬਹੁਤ ਜ਼ਰੂਰੀ ਹੈ ਪਾਣੀ ਦਾ ਬਚਾਓ ਸਾਂ ਸਾਡੇ ਲਈ ਬਹੁਤ ਜ਼ਰੂਰੀ ਹੈ